ਮੈਨੂੰ ਨੌਕਰੀ ਮੈਨਜਮੈਂਟ ਏਰੀਆ 'ਚ ਚਾਹੀਦੀ ਹੈ ਜਿੱਥੇ ਤਾਂ ਕਿ ਮੇਰੀ ਬੀਕੌਮ ਦੀ ਪੜ੍ਹਾਈ ਮੇਰੇ ਕੰਮ ਆਵੇ ਅਤੇ ਮੈਨੂੰ ਇੱਕ ਵਧੀਆ ਤਨਖਾਹ ਮਿਲੇ ਜਿਸ ਰਾਹੀਂ ਮੈਂ ਆਪਣੇ ਪਰਿਵਾਰ ਦੀ ਪੈਸਿਆਂ ਰਾਹੀਂ ਮਦਦ ਕਰ ਸਕਾਂ ਅਤੇ ਆਪਣਾ ਇੱਕ ਵਧੀਆ ਘਰ ਬਣਾ ਸਕਾਂ ਮੇਰੇ ਸਹਿਯੋਗ ਮੇਰੇ ਜਿੰਨੇ ਵੀ ਸਹਿਯੋਗੀ ਹਨ ਉਹ ਵੀ ਮੇਰੀ ਮਦਦ ਕਰਨ ਅਤੇ ਮੈਂ ਵੀ ਉਹਨਾਂ ਦੀ ਮਦਦ ਕਰਾਂ ਔਫਿਸ ਵਿੱਚ ਕੋਈ ਭੇਦ ਭਾਵ ਨਾ ਹੋਵੇ ਮੇਰੇ ਮੇਰੇ ਸਭ ਨੂੰ ਇੱਕ ਸਮਾਨ ਹੀ ਸਮਝਿਆ ਜਾਵੇ